ਸਾਡੇ ਜ਼ਿਲ੍ਹੇ ਦੇ ਵਿੱਚ ਆਮ ਤੌਰ 'ਤੇ ਲੋਕਾਂ ਨੂੰ ਜਦੋਂ ਘਰ ਦੇ ਵਿੱਚ ਨਵੇਂ ਬੱਚੇ ਜੰਮਦੇ ਹਨ ਤਾਂ ਟੀਕਾਕਰਨ ਕਰਨ ਲਈ ਆ ਜਾਂਦੇ ਹਨ ਇਸ ਤਰ੍ਹਾਂ ਲੋਕਾਂ ਨੂੰ ਜੋ ਕਿ ਛੋਟੇ ਬੱਚੇ ਉਹਨਾਂ ਦੇ ਹੁੰਦੇ ਹਨ ਉਹਨਾਂ ਨੂੰ ਅਸਾਨੀ ਦੇ ਨਾਲ ਬਹੁਤ ਆਮ ਜੋ ਟੀਕੇ ਉਹਨਾਂ ਦੇ ਲੱਗਣੇ ਹੁੰਦੇ ਹਨ ਉਹ ਲੱਗ ਜਾਂਦੇ ਹਨ ਕਈ ਵਾਰ ਜਿੱਦਾਂ ਅਸੀਂ ਦੇਖਦੇ ਹਾਂ ਕਿ ਜਦੋਂ ਜੋ ਲੋਕ ਪਿੰਡਾਂ ਦੇ ਵਿੱਚ ਹੁੰਦੇ ਹਨ ਜੋ ਸਾਡੇ ਜ਼ਿਲ੍ਹੇ ਦੇ ਨੇੜੇ ਤੇੜੇ ਹਨ ਉਹਨਾਂ ਦੇ ਲਈ ਇੱਕ ਪੂਰੇ ਚੰਗੇ ਤਰੀਕੇ ਨਾਲ ਟੀਕਾਕਰਨ ਕੇਂਦਰ ਨਹੀਂ ਬਣੇ ਹੋਏ ਹਨ ਇਸ ਲਈ ਉਹਨਾਂ ਨੂੰ ਸਰੋਤਾਂ ਦੀ ਘਾਟ ਬਹੁਤ ਹੀ ਜ਼ਿਆਦਾ ਮਹਿਸੂਸ ਹੋਣ ਲੱਗ ਪੈਂਦੀ ਹੈ ਜਿੱਦਾਂ ਕਿ ਟੀਕਾਕਰਨ ਦੇ ਕੇਂਦਰ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੇ ਹਨ ਤਾਂ ਕਿ ਜੋ ਕਿ ਲੋਕ ਹਨ ਇੱਕ ਖੇਤਰ ਦੇ ਉਹ ਬਹੁਤ ਹੀ ਤੰਦਰੁਸਤ ਰਹਿ ਸਕਣ ਨਾ ਹੀ ਉਹਨਾਂ ਨੂੰ ਕੋਈ ਬਿਮਾਰੀਆਂ ਲੱਗ ਸਕਣ ਜਿੱਦਾਂ ਕਿ ਅਸੀਂ ਪਿੱਛੇ ਗੁਜ਼ਰੀ ਕਰੋਨਾ ਦੀ ਸਥਿਤੀ ਨੂੰ ਦੇਖ ਸਕਦੇ ਹਾਂ ਜੇਕਰ ਉਸ ਸਥਿਤੀ ਨੂੰ ਮੱਦੇ ਨਜ਼ਰ ਰੱਖੀਏ ਤਾਂ ਫਿਰ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ ਆਪਣਾ ਕਰੋਨਾ ਦੀ ਵੈਕਸੀਨ ਦਾ ਟੀਕਾ ਲਗਵਾਉਣ ਦੇ ਲਈ ਇਹਨਾਂ ਸਰੋਤਾਂ ਦੀ ਘਾਟ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਦੇਖਣੀ ਪਈ ਅਤੇ ਕੁਝ ਕੁ ਜੋ ਕੇਂਦਰ ਹਨ ਟੀਕਾਕਰਨ ਦੇ ਉਹਨਾਂ ਦੀ ਗਿਣਤੀ ਘੱਟ ਹੈ ਜਦਕਿ ਸਾਡੇ ਆਲੇ ਦੁਆਲੇ ਦੇ ਪਿੰਡ ਜ਼ਿਲ੍ਹੇ ਦੇ ਨਾਲ ਲੱਗਦੇ ਅਤੇ ਸਾਡੇ ਜ਼ਿਲ੍ਹੇ ਦੇ ਵਿੱਚ ਲੋਕਾਂ ਦੀ ਗਿਣਤੀ ਥੋੜ੍ਹੀ ਵੱਧ ਹੈ ਇਸ ਲਈ ਟੀਕਾਕਰਨ ਕੇਂਦਰਾਂ ਦੀ ਥੋੜ੍ਹੀ ਕਮੀ ਹੈ